ਮੈਨੂੰ ਗਲਪ ਬਾਰੇ ਲਿਖਣਾ ਬਹੁਤ ਪਸੰਦ ਹੈ ਗਲਪ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਜਦੋਂ ਦੀ ਮੈਂ ਆਪਣੀ ਮਾਤਾ ਜੀ ਨੂੰ ਸਾਹਿਤ ਨਾਲ ਜੁੜਿਆ ਦੇਖਿਆ ਹੈ ਤਾਂ ਮੇਰਾ ਗਲਪ ਵਿੱਚ ਬਹੁਤ ਹੀ ਇੰਟਰਸਟ ਬਣ ਚੁੱਕਿਆ ਗਾ ਮੈਂ ਕਾਲਪਨਿਕ ਕਹਾਣੀਆਂ ਬਾਰੇ ਜਦੋਂ ਸੁਣਦੀ ਹਾਂ ਤਾਂ ਮੈਨੂੰ ਬਹੁਤ ਹੀ ਆਨੰਦ ਮਿਲਦਾ ਗਾ ਗਲਪ ਦਾ ਮਤਲਬ ਹੀ ਕਲਪਨਾ ਹੁੰਦਾ ਗਾ ਜਦੋਂ ਆਪਾਂ ਸਪਾਈਡਰ ਮੈਨ ਜਾਂ ਫਿਰ ਪਰੀਆਂ ਦੀਆਂ ਕਹਾਣੀਆਂ ਸੁਣਦੇ ਹਾਂ ਉਹ ਵੀ ਇੱਕ ਗਲਪ ਹੈ ਜਦੋਂ ਆਪਾਂ ਜਾਦੂ ਜਾਂ ਫਿਰ ਕੋਈ ਵੀ ਕਾਲਪਨਿਕ ਦ੍ਰਿਸ਼ ਦੇਖਦੇ ਹਾਂ ਉਹ ਵੀ ਇੱਕ ਗਲਪ ਹੁੰਦਾ ਗਾ ਗਲਪ ਬੰਦੇ ਦਾ ਬਹੁਤ ਮਨੋਰੰਜਨ ਕਰਦਾ ਗਾ ਆਪਾਂ ਗਲਪ ਨ ਗਲਪ ਦੀ ਮਦਦ ਨਾਲ ਚੰਗੇ ਵਿਅਕਤੀ ਨੂੰ ਹੋਰ ਅੱਗੇ ਕਿਵੇਂ ਆਪਾਂ ਦੂਜਿਆਂ ਦਾ ਵਿਕਾਸ ਕਰ ਸਕਦੇ ਹਾਂ ਸਿਖਾ ਸਕਦੇ ਹਾਂ ਗਲਪ ਬੰਦੇ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਕਰਦਾ ਗਾ ਜੇ ਕੋਈ ਬੰਦਾ ਕਾਲੇ ਜਾਦੂ ਵਿੱਚ ਘਿਰਿਆ ਗਾ ਤਾਂ ਆਪਾਂ ਉਸ ਨੂੰ ਗਲਪ ਦੀ ਮਦਦ ਨਾਲ ਉਸ ਜਾਦੂ ਵਿੱਚੋਂ ਬਾਹਰ ਕੱਢ ਸਕਦੇ ਹਾਂ ਗਲਪ ਬਹੁਤ ਹੀ ਵਧੀਆ ਹੈ ਆਪਾਂ ਗਲਪ ਕਰਕੇ ਬਹੁਤ ਕੁਛ ਹਾਸਿਲ ਕਰ ਸਕਦੇ ਹਾਂ ਆਪਾਂ ਜੋ ਸੋਚ ਵੀ ਨਹੀਂ ਸਕਦੇ ਉਹ ਆਪਾਂ ਗਲਪ ਰਾਹੀਂ ਹਾਸਿਲ ਕਰ ਸਕਦੇ ਹਾਂ ਉਸ ਮਕਸਦ ਤੱਕ ਆਪਾਂ ਗਲਪ ਰਾਹੀਂ ਪਹੁੰਚ ਸਕਦੇ ਹਾਂ